ਹੈਲੋ ਸਤਿ ਸ੍ਰੀ ਅਕਾਲ ਜੀ ਤੁਸੀਂ ਹੋਸ਼ਿਆਰਪੁਰ ਦੇ ਹੀ ਹੋ ਅੱਛਾ ਇਹ ਕਿੱਧਰਲੇ ਪਾਸੇ ਰਹਿੰਦੇ ਤੁਸੀਂ ਅੱਛਾ ਅੱਛਾ ਜੀ ਮੈਂ ਰਾਮਗੜੀਆਂ ਚੈਨ ਦੇ ਕੋਲ ਰਹਿੰਨੀ ਆ ਉਥੇ ਤੁਸੀਂ ਪੁੱਛੋ ਹੀ ਨਾ ਉਥੇ ਸੱਚੀ ਬਹੁਤ ਜਿਆਦਾ ਟਰੈਫਿਕ ਹੁੰਦਾ ਦਿਨ ਰਾਤ ਆਵਾਜਾਈ ਲੱਗੀ ਰਹਿੰਦੀ ਆ ਹਾਂਜੀ ਅੱਛਾ ਜੀ

ਟਰੈਫਿਕ ਤਾਂ ਉੱਧਰ ਬਹੁਤ ਹੁੰਦਾ ਜੇ ਗਵਰਮੈਂਟ ਕਾਲਜ ਵੱਲ ਜਾਈਏ ਤਾਂ ਉੱਥੇ ਐਨਾ ਟਰੈਫਿਕ ਗੋਰਮੈਂਟ ਕੋਲਜ ਵੱਲ ਨੂੰ

ਮਤਲਬ ਉਧਰ ਤਾਂ ਹਾਂਜੀ ਹਾਂਜੀ ਉੱਧਰ ਤਾਂ ਮਤਲਵ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਉਧਰ ਬਹੁਤ ਟਰੈਫਿਕ ਰਹਿੰਦਾ ਤੇ ਉੱਥੇ ਮਤਲਬ ਕਿ ਕਈ ਮੁੰਡੇ ਸਹੀ ਤਰੀਕੇ ਨਾਲ ਚਲਾਉਂਦੇ ਹੁਦੰਗ ਮਚਾਉੰਦੇ ਜਾਂਦੇ ਉੱਥੇ ਐਨੀ ਨਾ ਅੱਛਿਆ ਹਾਂਜੀ ਲੋਕ ਇੱਦਾਂ ਈ ਕਰਦੇ ਆ ਜੇ ਅਸੀਂ ਆਪ ਸਹੀ ਚਲਾਈਏ ਤਾਂ ਦੂਸਰਾ ਬੰਦਾ ਸਹੀ ਨੀ ਚਲਾਂਦਾ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਈ ਨੀ ਕਰਦੇ ਕਈ ਲੋਕ ਤੇ ਸਹੀ ਤਰੀਕੇ ਨਾਲ ਹਾਂਜੀ ਅੱਛਾ ਜੀ ਜੀ ਹਾਂਜੀ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਆ ਤੇ ਮਤਲਬ ਕਈ ਛੋਟੇ ਛੋਟੇ ਨਿਆਣਿਆਂ ਨੂੰ ਬਾਈਕ ਵਗੈਰਾ ਚਲਾਉਣ ਨੂੰ ਦੇ ਦਿੰਦੇ ਜਿਹਦੇ ਨਾਲ ਐਕਸੀਡੈਂਟ ਵੱਧਦੇ ਇਹ ਨਹੀਂ ਹੋਣਾ ਚਾਹੀਦਾ ਅਠਾਰਾਂ ਸਾਲ ਦੇ

ਹਾਂਜੀ ਹਾਂਜੀ ਹਾਂਜੀ ਪੁਲਿਸ ਵੀ ਮਤਲਬ ਹਾਂਜੀ ਪੁਲਿਸ ਵੀ ਕੰਮ ਕਰ ਰਹੀ ਹੈ ਬਾਕੀ ਜਨਤਾ ਨੂੰ ਵੀ ਚਾਹੀਦਾ ਹੈ ਕਿ ਸਹੀ ਤਰੀਕੇ ਨਾਲ ਚਲਾਵੇ ਚਲੋ ਠੀਕ ਹੈ ਜੀ ਫਿਰ ਹੁਣ ਓਕੇ ਧੰਨਵਾਦ ਜੀ